ਪੰਜਾਬ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਰਿਗਵੈਦਿਕ ਕਾਲ ਦੇ ਵਿੱਚ ਪੰਜਾਬ ਦੇ ਵਿੱਚ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਅਤੇ ਪੰਜਾਬ ਹੌਲੀ ਹੌਲੀ ਪੰਜਾਬ ਦੇ ਵਿੱਚ ਪੰਜ ਪਲੱਸ ਆਬ ਪੰਜ ਦਰਿਆ ਦੀ ਧਰਤੀ ਰਹਿ ਗਈ ਸੀ ਅਤੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਤਿੰਨ ਦਰਿਆ ਹਨ ਸਤਲੁਜ ਬਿਆਸ ਅਤੇ ਰਾਵੀ ਇਹਨਾਂ ਨੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਪੰਜਾਬ ਦੇ ਪੰਜਾਬ ਦੇ ਉੱਤਰ ਦੇ ਹਿਮਾਲਿਆ ਪਰਬਤਾਂ ਦੇ ਵਿੱਚ ਹੇਠਲੇ ਭਾਗ ਦੇ ਵਿੱਚ ਸ਼ਿਵਾਲਿੰਗ ਪਹਾੜੀਆਂ ਕਰਕੇ ਪੰਜਾਬ ਦੇ ਵਿੱਚ ਗਰਮੀ ਸਰਦੀ ਪੱਤਝੜ ਮਾਨਸੂਨ ਸਭ ਪ੍ਰਕਾਰ ਦਾ ਵਾਤਾਵਰਨ ਮੌਜੂਦ ਹੈ ਜੋ ਦੁਨੀਆ ਦੇ ਕਿਸੇ ਵੀ ਧਰਤੀ 'ਤੇ ਇਹ ਚੀਜ਼ ਮੌਜੂਦ ਨਹੀਂ ਹੈ ਪੰਜਾਬ ਦੇ ਵਿੱਚ ਉੱਤਰ ਸਾਈਡ ਹਿਮਾਲ ਅ ਹਿਮਾਚਲ ਪ੍ਰਦੇਸ਼ ਲੱਗਦਾ ਹੈ ਅਤੇ ਦੱਖਣ ਸਾਈਡ ਹਰਿਆਣਾ ਰਾਜਸਥਾਨ ਲੱਗਦਾ ਹੈ ਅਤੇ ਪੰਜਾਬ ਦੇ ਪੱਛਮੀ ਸਾਈਡ ਪਾਕਿਸਤਾਨ ਨਾਲ ਪੰਜਾਬ ਦੀ ਹੱਦ ਲੱਗਦੀ ਹੈ ਪੰਜਾਬ ਦੇ ਵਿੱਚ ਸਤਲੁਜ ਬਿਆਸ ਅਤੇ ਰਾਵੀ ਕਰਕੇ ਪੰਜਾਬ ਦਾ ਵਾਤਾਵਰਣ ਅਤੇ ਭੂਗੋਲਿਕ ਸਥਿਤੀ ਬਹੁਤ ਵਧੀਆ ਮਜਬੂਤ ਦੇ ਰਾਹ 'ਤੇ ਹੈ ਪੰਜਾਬ ਦੇ ਵਿੱਚ ਇਹਨਾਂ ਦਰਿਆਵਾਂ ਕਰਕੇ ਜਲੋੜ ਮਿੱਟੀ ਪੈਦਾ ਹੋਈ ਹੈ ਜਲੋੜ ਮਿੱਟੀ ਦੇ ਦੁਆਰਾ ਹੀ

ਜਾ ਰਹੀਆਂ ਹਨ ਜਿਸ ਕਰਕੇ ਪੰਜਾਬ ਦੇ ਕਿਸਾਨ ਗਰੀਬ ਪਰਿਵਾਰ ਮਜ਼ਦੂਰ ਸਭ ਦੇ ਲਈ ਇਹ ਚੀਜ਼ਾਂ ਕੀ ਹੈ ਫਾਇਦੇਮੰਦ ਹਨ ਪੰਜਾਬ ਦੇ ਵਿੱਚ ਕਿਸਾਨਾਂ ਦੀ ਪ੍ਰਤੀ ਵਿਅਕਤੀ ਆਮਦਨ ਕਰਕੇ ਪੰਜਾਬ ਦਿਨ ਪ੍ਰਤੀ ਦਿਨ ਖੁਸ਼ਹਾਲ ਹੁੰਦਾ ਜਾ ਰਿਹਾ ਭਾਰਤ ਦੇ ਉੱਪਰਲੇ ਰਾਜਾਂ ਦੇ ਵਿੱਚ ਖੁਸ਼ਹਾਲ ਰਾਜਾਂ ਦੇ ਵਿੱਚ ਇਸ ਨੇ ਆਪਣਾ ਪਹਿਲਾ ਸਥਾਨ ਵੀ ਹਾਸਲ ਕੀਤਾ ਹੋਇਆ ਹੈ ਪੰਜਾਬ ਦੇ ਭੂਗੋਲ ਅਤੇ ਵਾਤਾਵਰਨ ਨੂੰ ਨਹੀਂ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਬਹੁਤ ਉੱਪਰ ਚੁੱਕਿਆ ਹੈ ਦੂਜੇ ਸੂਬਿਆਂ ਨਾਲੋਂ ਪੰਜਾਬ ਦਾ ਭੂਗੋਲ ਵਾਤਾਵਰਨ ਸਭ ਤੋਂ ਅਲੱਗ ਹੈ ਇੱਥੋਂ ਤੱਕ ਜੇ ਆਪਾਂ ਗੱਲ ਕਰੀਏ ਦੁਨੀਆ ਦੇ ਵਿੱਚ ਆਪਾਂ ਕਿਤੇ ਵੀ ਚਲੇ ਜਾਈਏ ਪੰਜਾਬ ਵਰਗਾ ਭੂਗੋਲ ਅਤੇ ਵਾਤਾਵਰਨ ਕਿਤੇ ਵੀ ਨਹੀਂ ਮੌਜੂਦ ਹੈਗਾ ਪੰਜਾਬ ਦੇ ਵਿੱਚ ਸਭ ਤੋਂ ਖੁਸ਼ਹਾਲ ਲੋਕ ਅਤੇ ਸਭ ਤੋਂ ਦਾਨੀ ਅਤੇ ਨਿਡਰ ਅਤੇ ਬਹਾਦਰੀ ਦੇ ਲੋਕ ਪੰਜਾਬ ਦੇ ਵਿੱਚ ਹੀ ਮੌਜੂਦ ਹਨ ਪੰਜਾਬ ਨੇ ਪੰਜਾਬ ਦੀ ਭੂਗੋਲਿਕ ਅਤੇ ਵਾਤਾਵਰਨ ਨੇ ਅਤੇ ਦਾਨੀ ਲੋਕਾਂ ਨੇ ਪੰਜਾਬ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਹੈ